ਹੈਲੋ ਸਰ ਸਵਿਗੀ ਤੋਂ ਬੋਲ ਰਹੇ ਸਰ ਅਸੀਂ ਰੈਸਟੋਰੈਂਟ ਵਿੱਚ ਭੋਜਨ ਲਈ ਆਰਡਰ ਦੇ ਰਹੇ ਹਾਂ ਪਰ ਭੋਜਨ ਵਿੱਚ ਇੱਕ ਖ਼ਾਸ ਕਿਸਮ ਦੀ ਬੇਨ ਸੋਧ ਲਈ ਬੇਨਤੀ ਕਰਨੀ ਚਾਹੁੰਦੇ ਹਾਂ ਬੇਨਤੀ ਇਸ ਤਰ੍ਹਾਂ ਹੈ ਕਿ ਸਰ ਜੋ ਵੀ ਇਨਾ ਰਸ ਮਲਾਈ ਪੇਸਟੀ ਗੁਲਾਬ ਜਾਮੁਨ ਅਸੀਂ ਆਰਡਰ ਕੀਤੇ ਹੋਏ ਆ ਉਸ ਵਿੱਚ ਜਿਹੜੀ ਖੰਡ ਦੀ ਮਾਤਰਾ ਹੈ ਉਹ ਕਾਫ਼ੀ ਘੱਟ ਚਾਹੀਦੀ ਹੈ ਕਿਉਂਕਿ ਅਸੀਂ ਪੂਰਾ ਪਰਿਵਾਰ ਕੁਛ ਰਿਸ਼ਤੇਦਾਰ ਬੱਚੇ ਸਾਡੇ ਨਾਲ ਆ ਰਹੇ ਆ ਜਿਸ ਅਸੀਂ ਮਿੱਠਾ ਜਿਹੜਾ ਅਸੀਂ ਘੱਟ ਹੀ ਸੇਵਨ ਕਰਦੇ ਹਾਂ ਇਸ ਲਈ ਇਹ ਨਾ ਇਹਨਾਂ ਚੀਜ਼ਾਂ ਵਿੱਚ ਜਿਹੜਾ ਉਹ ਮਿੱਠੇ ਦੀ ਮਾਤਰਾ ਬਹੁਤ ਹੀ ਘੱਟ ਹੋਵੇ ਸਰ ਦੂਸਰਾ ਕੜਾਹੀ ਪਨੀਰ ਚਨੇ ਅਤੇ ਦਾਲ ਮੱਖਣੀ ਵਿੱਚ ਮਸਾਲੇਦਾਰ ਜਿਹੜੇ ਜਿਹੜੇ ਮਸਾਲੇ ਜਿਹੜੇ ਉਹ ਘੱਟ ਹੀ ਪਾਏ ਜਾਣ ਇਹ ਨਾ ਕਿਉਂਕਿ ਬੱਚੇ ਵੀ ਆ ਸਾਡੇ ਨਾਲ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਨ ਖਾਣ ਵਿੱਚ ਅਤੇ ਇਸ ਤਰ੍ਹਾਂ ਅਸੀਂ ਭੋਜਨ ਦਾ ਆਨੰਦ ਲੈ ਸਕੀਏ ਅਤੇ ਸਾਡੇ ਰਿਸ਼ਤੇਦਾਰ ਪਰਿਵਾਰ ਨੂੰ ਕੋਈ ਵੀ ਦਿੱਕਤ ਨਾ ਹੋਵੇ ਖਾਣ 'ਚ ਇਹ ਨਾ ਕਿਉਂਕਿ ਅਸੀਂ ਘੱਟ ਮਾਤਰਾ ਵਿੱਚ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਾਂ ਅਤੇ ਘੱਟ ਮਿੱਠਾ ਹੀ ਖਾਣਾ ਪਸੰਦ ਕਰਦੇ ਨ ਸਰ ਜਿਸ ਤਰ੍ਹਾਂ ਤੁਸੀਂ ਆਰਡਰ ਦੇ ਮੁਤਾਬਿਕ ਹੀ ਭੋਜਨ ਤਿਆਰ ਕਰੋਗੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਅਤੇ ਅਸੀਂ ਭੋਜਨ ਦਾ ਆਨੰਦ ਲਵਾਂਗੇ ਅਤੇ ਅਸੀਂ ਇਸ ਤਰ੍ਹਾਂ ਇਹ ਨਾ ਤੁਹਾਡੇ ਹੋਰ ਗਾਹਕ ਵੱਧਣਗੇ ਨਾ ਅਸੀਂ ਦੱਸਾਂਗੇ ਨਾ ਜੋ ਵੀ ਹੈ ਇਹ ਔਡਰ ਦੇ ਮੁਤਾਬਿਕ ਰੈਸਟੋਰੈਂਟ ਵਾਲੇ ਭੋਜਨ ਤਿਆਰ ਕਰਦੇ ਹੈ ਇਸ ਲੀ ਬਹੁਤ ਬਹੁਤ ਤੁਹਾਡਾ ਧੰਨਵਾਦ ਓਕੇ